ਪੰਜਾਬੀ ਮਾਂ ਬੋਲੀ ਵਿੱਚ ਬਹੁਤ ਤਰ੍ਹਾਂ ਦੇ ਮੁਹਾਵਰਿਆਂ ਜਾਂ ਕਹਾਵਤਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਹਨਾਂ ਵਿੱਚ ਜਿਵੇਂ ਅੱਗ ਨਾਲ ਜਲੀ ਟਟਿਆਣਿਆਂ ਤੋਂ ਵੀ ਡਰਦੀ ਇਹ ਆਮ ਕਰਕੇ ਉੱਥੇ ਵਰਤਿਆ ਜਾਂਦਾ ਹੈ ਜਦੋਂ ਕਿਸੇ ਵਿਅਕਤੀ ਨਾਲ ਕੋਈ ਵੱਡਾ ਹਾਦਸਾ ਹੋ ਕੇ ਹਟਿਆ ਹੋਵੇ ਤਾਂ ਉਹ ਛੋਟੀ ਛੋਟੀਆਂ ਗਲਤੀਆਂ ਕਰਨ ਤੋਂ ਵੀ ਡਰਦਾ ਹੈ ਇਸੇ ਤਰ੍ਹਾਂ ਇੱਕ ਚੁੱਪ ਸੌ ਸੁੱਖ ਇਹ ਮੁਹਾਵਰਾ ਵੀ ਉੱਥੇ ਵਰਤਿਆ ਜਾਂਦਾ ਹੈ ਜਦੋਂ ਆਮ ਘਰਾਂ ਵਿੱਚ ਜਾਂ ਕਿਤੇ ਵੀ ਬਾਹਰ ਕੋਈ ਵਿਅਕਤੀ ਕਿਸੇ ਨੂੰ ਗਲਤ ਬੋਲ ਦਿੰਦਾ ਹੈ ਜੇਕਰ ਉਹ ਅੱਗੋਂ ਚੁੱਪ ਕਰਕੇ ਉਸ ਗੱਲ ਨੂੰ ਅਣਗੌਲਿਆ ਕਰ ਦੇਵੇ ਤਾਂ ਇਹ ਮੁਹਾਵਰਾ ਉੱਥੇ ਪੂਰੀ ਤਰ੍ਹਾਂ ਢੁੱਕਦਾ ਹੈ ਇੱਕ ਚੁੱਪ ਸੌ ਸੁੱਖ ਇਸੇ ਤਰ੍ਹਾਂ ਮੁਹਾਵਰਾ ਵਕਤ ਤੋਂ ਖੁੰਝੀ ਡੁੰਮਣੀ ਖਾਵੇ ਆਲ ਵਟਾਲ ਇਹ ਮੁਹਾਵਰਾ ਉੱਥੇ ਢੁੱਕਦਾ ਹੈ ਜਦੋਂ ਕੋਈ ਵਿਅਕਤੀ ਸਮੇਂ ਸਿਰ ਕੰਮ ਨਹੀਂ ਕਰ ਸਕਦਾ ਜਦੋਂ ਉਸ ਕੰਮ ਦਾ ਸਮਾਂ ਲੰਘ ਜਾਂਦਾ ਹੈ ਉਸ ਤੋਂ ਬਾਅਦ ਜਦੋਂ ਉਹ ਕੰਮ ਕਰਦਾ ਹੈ ਤਾਂ ਉਹ ਕੰਮ ਚੰਗਾ ਨਹੀਂ ਲੱਗਦਾ ਕੰਮ ਇੱਧਰ ਜ ਕੰਮ ਸਹੀ ਜਗ੍ਹਾ ਕਰਨ ਦੀ ਥਾਂ ਆਸ ਪਾਸ ਆਲੇ ਦੁਆਲੇ ਬੰਦਾ ਭੱਜਦਾ ਫਿਰਦਾ ਹੈ ਉੱਥੇ ਅਸੀਂ ਇਸ ਮੁਹਾਵਰੇ ਦੀ ਵਰਤੋਂ ਆਮ ਕਰ ਲੈਂਦੇ ਹਾਂ ਇਸੇ ਤਰ੍ਹਾਂ ਇੱਕ ਮੁਹਾਵਰਾ ਹੋਰ ਸੌ ਸੁਨਿਆਰ ਦੀ ਇੱਕ ਲੁਹਾਰ ਦੀ ਇਹ ਵੀ ਇ ਇਹ ਵੀ ਇਸੇ ਤਰ੍ਹਾਂ ਢੁੱਕਦਾ ਹੈ ਜਿਵੇਂ ਇੱਕ ਵਿਅਕਤੀ ਛੋਟੇ ਛੋਟੇ ਕੰਮ ਕਰਕੇ ਫੋਕੀ ਵਾਹ ਵਾਹ ਆਪਣੀ ਕਰਦਾ ਫਿਰੇ ਉਦੋਂ ਕੋਈ ਵਿਸ਼ੇਸ਼ ਵਿਅਕਤੀ ਇਸ ਤਰ੍ਹਾਂ ਦਾ ਇੱਕੋ ਹੀ ਕੰਮ ਕਰ ਦਿੰਦਾ ਹੈ ਜਿਹਦੇ ਨਾਲ ਉਹ ਸਾਰੇ ਉਹਦੇ ਪਹਿਲੇ ਵਾਲੇ ਬੰਦੇ ਦੇ ਕੰਮਾਂ 'ਤੇ ਪਾਣੀ ਫਿਰ ਜਾਂਦਾ ਹੈ ਇਸ ਲਈ ਸੌ ਸੁਨਿਆਰ ਦੀ ਇੱਕ ਲੁਹਾਰ ਦੀ ਇਹ ਮੁਹਾਵਰਾ ਆਮ ਵਰਤ ਲਿਆ ਜਾਂਦਾ